ਹਾਂ ਮੈਂ ਆਪਣੀ ਬੇਟੀ ਨੂੰ ਸਵੈਟਰ ਬਣਾਇਆ ਸੀਗਾ ਬਹੁਤ ਮੇਰੀ ਬੇਟੀ ਨੂੰ ਪਸੰਦ ਆਇਆ ਅਤੇ ਉਹਦੀਆਂ ਸਹੇਲੀਆਂ ਨੇ ਵੀ ਬਹੁਤ ਤਰੀਫ਼ ਕੀਤੀ ਵਈ ਕਿ ਮੇਰੀ ਬੇਟੀ ਨੂੰ ਕਿਹਾ ਕਿ ਆਪਣੀ ਮੰਮੀ ਕੋਲੋਂ ਮੇਰੇ ਲਈ ਵੀ ਸਵੈਟਰ ਬਣਵਾ ਕੇ ਦਿਉ ਤੇਰੀ ਮੰਮੀ ਨੇ ਤਾਂ ਬਹੁਤ ਅੱਛਾ ਡਿਜ਼ਾਇਨ ਪਾਇਆ ਹੈ ਅਤੇ ਮੇਰੇ ਡਿਜ਼ਾਇਨ ਦੀਆਂ ਬਹੁਤ ਸਿਫ਼ਤ ਕੀਤੀ ਉਹਦੀ ਸਹੇਲੀਆਂ ਨੇ ਵੀ ਅਤੇ ਮੇਰੀ ਬੱਚੀ ਨੂੰ ਵੀ ਬਹੁਤ ਪਸੰਦ ਆਇਆ ਅਤੇ ਉਨ੍ਹਾਂ ਨੇ ਅਲੱਗ ਅਲੱਗ ਮੈਨੂੰ ਬਣਾਉਣ ਵਾਸਤੇ ਉਹਨੂੰ ਤਕਰੀਬਨ ਦੋ ਹਫਤੇ ਲੱਗ ਗਏ ਅਤੇ ਮੇਰੀ ਬੇਟੀ ਨੇ ਫੋਨ ਵਿੱਚੋਂ ਨਿਕਾਲ ਕੇ ਡਿਜ਼ਾਈਨ ਮੈਨੂੰ ਦਿੱਤਾ ਕਿ ਮੰਮੀ ਇੱਦਾਂ ਦਾ ਤੁਸੀਂ ਬਣਾ ਸਕਦੇ ਹੋ ਮੈਂ ਕਿਹਾ ਹਾਂ ਮੈਂ ਕੋਸ਼ਿਸ਼ ਕਰੂੰਗੀ ਜ਼ਰੂਰ ਬਣਾ ਕੋਸ਼ਿਸ਼ ਕਰਨ 'ਤੇ ਬਣ ਹੀ ਸਕਦਾ ਹੈ ਅਤੇ ਫੇਰ ਮੈਂ ਬਜ਼ਾਰ ਗਈ ਮੈਂ ਬਜ਼ਾਰ ਜਾ ਕੇ ਉੱਨ ਲੈ ਕੇ ਖਰੀਦ ਕੇ ਲਿਆਈ ਅਤੇ ਮੇਰੀ ਬੇਟੀ ਨੂੰ ਵੀ ਕਲਰ ਵੀ ਬਹੁਤ ਪਸੰਦ ਆਇਆ ਅਤੇ ਡਿਜ਼ਾਈਨ ਵੀ ਬਹੁਤ ਪਸੰਦ ਆਇਆ ਜਦੋਂ ਮੇਰੀ ਬੇਟੀ ਪਾ ਕੇ ਕੋਲਜ ਗਈ ਤਾਂ ਸਾਰੇ ਪੁੱਛਣ ਬੇਟੀ ਨੂੰ ਕਿ ਇਹ ਕਿਸ ਨੇ ਬਣਾਇਆ ਕਿਸ ਨੇ ਬਣਾਇਆ ਤਾਂ ਮੇਰੀ ਬੇਟੀ ਨੇ ਕਿਹਾ ਮੇਰੀ ਮੰਮੀ ਨੇ ਬਣਾਇਆ ਅਤੇ ਉਹਦੀਆਂ ਫਰੈਂਡ ਉਹਦੀਆਂ ਸਹੇਲੀਆਂ ਸਾਰੀਆਂ ਤਰੀਫ ਕਰਨ ਲੱਗੀਆਂ ਅਤੇ ਕਹਿੰਦੀਆਂ ਆਂਟੀ ਬਹੁਤ ਅੱਛੇ ਸਵੈਟਰ ਬਣਾਉਂਦੇ ਸਾਨੂੰ ਵੀ ਬਣਾ ਕੇ ਦਿਓ ਤਾਂ ਮੈਂ ਕਿਹਾ ਵੀ ਹਾਂ ਮੈਂ ਜ਼ਰੂਰ ਦਵਾਂਗੀ ਕੋਈ ਬਾਤ ਨਹੀਂ ਜਿਸ ਤਰ੍ਹਾਂ ਦੀ ਮੇਰੀ ਬੇਟੀ ਉੱਦਾਂ ਦੀਆਂ ਤੇਰੀਆਂ ਸਹੇਲੀਆਂ ਮੈਂ ਜ਼ਰੂਰ ਦਵਾਂਗੀ ਬਣਾ ਕੈ